ਜਿਵੇਂ ਕਿ ਆਪ ਸਭ ਨੂੰ ਪਤਾ ਹੀ ਯੂਟਿਊਬ ਦੇ ਉੱਤੇ ਬਹੁਤ ਸਾਰੇ ਚੈਨਲ ਦਿਖਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਖਾਣ ਪੀਣ ਕਿਆਂ ਅਲੱਗ ਅਲੱਗ ਹੋਰ ਤਰ੍ਹਾਂ ਦੀਆਂ ਚੀਜ਼ਾਂ ਦੀ ਵੀ ਹੁੰਦੀਆਂ ਪਰ ਜਿਹੜੀ ਮੈਂ ਖਾਣ ਪੀਣ ਦੀ ਚੀਜ਼ਾਂ ਦਾ ਇੱਕ ਭੋਜਨ ਦਾ ਚੈਨਲ ਦੇਖਿਆ ਸੀ ਉਹ ਹੈਬਰਸ ਕਿਚਨ ਦਾ ਸੀਗਾ ਉਹ ਬਹੁਤ ਹੀ ਵਧੀਆ ਚੀਜ਼ਾਂ ਬਣਾਉਂਦੇ ਹਨ ਨਾ ਕਿ ਸਿਰਫ਼ ਉਹਦੇ ਵਿੱਚ ਵੈਜੀਟੇਰੀਅਨ ਹੁੰਦੀ ਉਹਦੇ ਵਿੱਚ ਨੋਨ ਵੈੱਜ ਚੀਜ਼ਾਂ ਵੀ ਹੁੰਦੀਆਂ ਹਨ ਅਤੇ ਮੈਂ ਉਸ ਤੋਂ ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ ਜਿਵੇਂ ਰਸਮਲਾਈ ਮਲਾਈ ਕੋਫਤਾ ਵਾਈਟ ਸੋਸ ਪਾਸਤਾ ਰਬੜੀ ਸੇਵੀਆਂ ਅਤੇ ਨੋਨ ਵੈੱਜ ਦੇ ਵਿੱਚ ਬਟਰ ਚਿਕਨ ਕਿਵੇਂ ਬਣਦਾ ਹੈ ਫ਼ ਮੱਛੀ ਦੇ ਪਕੌੜੇ ਕਿਵੇਂ ਬਣਦੇ ਹਨ ਅਤੇ ਹੋਰ ਵੀ ਇੱਕ ਬਰਿਆਨੀ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਨੇ ਦੱਸੀ ਸੀਗੀ ਅਤੇ ਜਦੋਂ ਮੈਂ ਘਰੇ ਉਹਨੂੰ ਇੱਕ ਵਾਰ ਟਰਾਈ ਕੀਤਾ ਤਾਂ ਸਾਰਿਆਂ ਨੇ ਉਹਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਅਤੇ ਮੈਨੂੰ ਉਹਨਾਂ ਦੀ ਜਿਹੜਾ ਚੈਨਲ ਉਹ ਇੰਨਾ ਵਧੀਆ ਲੱਗਦਾ ਕਿ ਹਰ ਇੱਕ ਚੀਜ਼ ਨੂੰ ਬੜੇ ਵਧੀਆ ਤਰੀਕੇ ਨਾ ਦੱਸਦੇ ਹਨ ਅਤੇ ਨਾਲ ਹੀ ਦਿਖਾਉਂਦੇ ਵੀ ਹਨ ਔਰ ਜਿਵੇਂ ਦਾ ਉਹ ਬਣਾਉਂਦੇ ਹਨ ਉਵੇਂ ਦਾ ਹੀ ਸਵਾਦ ਅਸਲ ਦੇ ਵਿੱਚ ਆਉਂਦਾ ਹੈ